ਹਾਂ ਅਸੀਂ ਆਪਣੇ ਬੱਚਿਆਂ ਨੂੰ ਬੈਂਕਿੰਗ ਖੇਤਰ ਵਿੱਚ ਤਰਜੀਹ ਦੇਵਾ ਦੇਣੀ ਚਾਹਵਾਂਗੇ ਕਿਉਂਕਿ ਬੈਂਕਿੰਗ ਖੇਤਰ ਇੱਕ ਅਜਿਹਾ ਖੇਤਰ ਹੈ ਜਿਸ ਨਾਲ ਸਾਡੇ ਬੱਚੇ ਕੰਮ ਦੇ ਦੌਰਾਨ ਆਰਾਮ ਵੀ ਵਧੀਆ ਹੈ ਅਤੇ ਨਾ ਹੀ ਬੰਦਾ ਥੱਕਦਾ ਹੈ ਅਤੇ ਉਹਦੇ ਨਾਲ ਸਾਨੂੰ ਪੇ ਸਕੇਲ ਵੀ ਚੰਗਾ ਮਿਲ ਜਾਂਦਾ ਹੈ ਉੱਥੇ ਅਸੀਂ ਕਦੇ ਵੀ ਬੈਠੇ ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਕੰਮ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਨੂੰ ਡੇਲੀ ਕੋਈ ਨਾ ਕੋਈ ਮੰਨ ਲਓ ਉੱਥੇ ਬੰਦਾ ਹੈ ਨਾ ਉੱਥੇ ਕੋਈ ਕ ਕਸਟਮਰ ਕੋਈ ਨਵੀਂ ਆਪਣੀ ਲੈ ਕੇ ਆਉਂਦਾ ਲੋੜ ਮੁਤਾਬਿਕ ਅਸੀਂ ਉਹਦਾ ਹੱਲ ਕਰਦੇ ਹਾਂ ਅਤੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਜਦੋਂ ਅਸੀਂ ਕਿਸੇ ਦਾ ਕੋਈ ਕੰਮ ਕਰਦੇ ਹਾਂ ਮੰਨ ਲਓ ਚਾਹੇ ਸਾਡੀ ਡਿਊਟੀ ਹੈ ਪਰ ਫਿਰ ਵੀ ਜਦੋਂ ਅਸੀਂ ਕਿਸੇ ਦਾ ਮੰਨ ਲੋ ਕੰਮ ਕਰਾਂਗੇ ਤਾਂ ਉਹਦੇ ਨਾਲ ਉਹਦੀ ਜਿਹੜੀ ਆਪਣੇ ਆਪਣੇ ਸੰਤੁਸ਼ਟੀ ਮਿਲਦੀ ਬਹੁਤ ਸੰਤੁਸ਼ਟੀ ਮਿਲਦੀ ਹੈ ਇਸ ਲਈ ਅਸੀਂ ਤਾਂ ਆਪਣੇ ਬੱਚਿਆਂ ਨੂੰ ਚਾਹਵਾਂਗੇ ਵਿ ਬੈਂਕਿੰਗ ਖੇਤਰ ਜਿਹੜੀ ਹੈ ਉਹਦੇ ਵਿੱਚ ਸਾਨੂੰ ਜਾਣਾ ਚਾਹੀਦਾ ਸੀ ਆਪਣੇ ਬੱਚਿਆਂ ਨੂੰ ਇਹੀ ਕਹਾਂਗੇ ਅਸੀਂ ਸਾਡੀ ਭੂਮਿਕਾ ਨੇ ਬੱਚਿਆਂ ਪ੍ਰਤੀ ਇਹ ਹੋਵੇਗੀ ਕਿ ਮੈਂ ਅਸੀਂ ਉਹਨਾਂ ਨੂੰ ਪਹਿਲਾਂ ਕੋਚਿੰਗ ਦਵਾਵਾਂਗੇ ਕਿ ਬੈਂਕਿੰਗ ਖੇਤਰ ਵਿੱਚ ਸੈੱਟ ਲਈ ਜਾਂ ਆਨਲਾਈਨ ਅਸੀਂ ਕੋਰਸ ਦੁਆਵਾਂਗੇ ਤਾਂ ਜੋ ਵਧੀਆ ਤਿਆਰੀ ਕਰ ਸਕਦੇ ਬੈਂਕਿੰਗ ਲਾਇਨ ਦੇ ਪੇਪਰ ਦੇ ਕੇ ਕਿ ਬੈਂਕਿੰਗ ਸੈਕਟਰ ਵਿੱਚ ਜਾਵਾਂਗੇ ਜੇ ਅਸੀਂ ਗੱਲ ਕਰੀਏ ਅਸੀਂ ਬੈਂਕ ਗਵਰਮੈਂਟ ਜੋਬ ਦੀ ਜੇ ਬੈਂਕ ਜੋ ਜਾਣਾ ਹੋਵੇ ਤਾਂ ਅਸੀਂ ਇੱਕ ਦੋ ਪੇਪਰ ਪਰੀ ਔਰ ਮੇਨ ਕੱਢ ਕੇ ਉਹਦੇ ਬਾਅਦ ਇੰਟਰਵਿਊ ਹੋ ਕੇ ਅਸੀ ਤਾਂ ਅਸੀਂ ਬੈਂਕਿੰਗ ਖੇਤਰ ਵਿੱਚ ਜਾ ਸਕਦੇ ਹਾਂ ਜੇ ਅਸੀਂ ਮੰਨ ਲੋ ਅਸੀਂ ਕਿਸੇ ਪ੍ਰਾਈਵੇਟ ਸੈਕਟਰ ਬੈਂਕ ਵਿੱਚ ਜਾਣਾ ਹੋਵੇ ਤਾਂ ਅਸੀਂ ਉੱਥੇ ਇੱਕ ਵਧੀਆ ਆਪਣੀ ਇੰਟਰਵਿਊ ਦੇ ਕੇ ਅਸੀਂ ਉੱਥੇ ਵੀ ਅਸੀਂ ਜੋਬ ਕਰ ਸਕਦੇ ਹਾਂ ਪਰ ਬ ਫਰਕ ਇੰਨਾ ਹੁੰਦਾ ਕਿ ਪ੍ਰਾਈਵੇਟ ਸੈਕਟਰ ਅਤੇ ਪ੍ਰਾਈਵੇਟ ਜੋਬ ਨਾਲੇ ਗੋਰਮੈਂਟ ਜੋਬ ਦਾ ਥੋੜ੍ਹਾ ਜਿਹਾ ਫਰਕ ਰਹਿ ਜਾਂਦਾ ਕਿਉਂਕਿ ਉੱਥੇ ਪੇ ਸਕੇਲ ਥੋੜ੍ਹਾ ਜਿਹਾ ਫਰਕ ਹੁੰਦਾ ਅਤੇ ਪ੍ਰਾਈਵੇਟ ਸੈਕਟਰ ਵਿੱਚ ਟਾਰਗੇਟ ਹੁੰਦੇ ਆ ਥੋੜ੍ਹੀ ਜਿਹੀ ਮਨ 'ਤੇ ਥੋੜ੍ਹੀ ਟੈਨਸ਼ਨ ਲੈਣੀ ਪੈਂਦੀ ਉਹ ਤਾਂ ਦਿਮਾਗ 'ਤੇ ਕੰਮ ਹੁੰਦੇ ਆ ਅਤੇ ਜਿਹੜੀ ਗੌਰਮੈਂਟ ਜੋਬ ਦੇ ਬੈਂਕ ਹੈ ਉਹ 'ਚ ਥੋੜ੍ਹੀ ਜੀ ਬੰਦੇ ਨੂੰ ਆਪਣੀ ਬ ਰਿਟਾਇਰਮੈਂਟ ਤੋਂ ਬਾਅਦ ਵੀ ਥੋੜ੍ਹੀ ਪੈਨਸ਼ਨ ਦੀ ਸਹੂਲਤ ਮਿਲ ਜਾਂਦੀ ਹੈ ਇਸ ਲਈ ਬੈਂਕਿੰਗ ਸੈਕਟਰ ਨੂੰ ਅਸੀਂ ਵਧੀਆ ਮੰਨਦੇ ਹਾਂ